ਭਾਰਤ ਵਿੱਚ ਸਭ ਤੋਂ ਪ੍ਰਸਿੱਧ ਖੇਡਾਂ ਕ੍ਰਿਕਟ ਕਬੱਡੀ ਫੁੱਟਬਾਲ ਟੇਬਲ ਟੈਨਿਸ ਬੈਡਮਿੰਟਨ ਟੈਨਿਸ ਲੋਂਗ ਜੰਪ ਹਾਈ ਜੰਪ ਕੁਸ਼ਤੀ ਬਾਕਸਿੰਗ ਚੇਸ ਕਰਾਟੇ ਰਨਿੰਗ ਆਦਿ ਹਨ ਇਸ ਵਿੱਚੋਂ ਮੈਨੂੰ ਸਭ ਤੋਂ ਪਸੰਦ ਕ੍ਰਿਕਟ ਹੈ ਜੋ ਕਿ ਜੋ ਕਿ ਕ੍ਰਿਕਟਰ ਵਿਰਾਟ ਕੋਹਲੀ ਹੈ ਉਸਦੇ ਮੈਚ ਅਸੀਂ ਦੇਖਦੇ ਰਹਿੰਦੇ ਹਾਂ ਅਤੇ ਉਹ ਬਹੁਤ ਵਧੀਆ ਉਹ ਆਪਣੀ ਕ ਕ੍ਰਿਕਟ ਵਿੱਚ ਬਹੁਤ ਵਧੀਆ ਪੇਸ਼ਕਸ਼ ਕਰਦਾ ਹੈ ਔਰ ਇਸ ਤੋਂ ਇਲਾਵਾ ਬੱਚਿਆਂ ਦੀਆਂ ਜੋ ਔਨਲਾਈਨ ਖੇਡਾਂ ਹਨ ਉਹ ਹਨ ਕੈਂਡੀ ਕਰੱਸ਼ ਪਬਜੀ ਫਰੀ ਫਾਇਰ ਜੀ ਟੀ ਏ ਆਦਿ ਖੇਡਾਂ ਹਨ ਜੋ ਜਿਸ ਤੋਂ ਕਿ ਬੱਚੇ ਆਪਣਾ ਖੇਡਾਂ ਦੁਆਰਾ ਆਪਣਾ ਮੰਨੋਰੰਜਨ ਕਰਦੇ ਹਨ ਅਤੇ ਆਪਣੇ ਦਿਮਾਗ ਨੂੰ ਤੇਜ਼ ਕਰਦੇ ਹਨ